ਹੈਲੋ ਹੈਲੋ ਹਾਂਜੀ ਅ ਯੋਗਾ ਕਲਾਸ ਮੈ ਮੈਡਮ ਬੋਲ ਬਾਤ ਕਰ ਰਹੇ ਹੋ ਹਾਂਜੀ ਯੋਗਾ ਕਲਾਸ ਕਾ ਮੈਨੇ ਪੂਛਨਾ ਥਾ ਕਿਆ ਸਿਸਟਮ ਹੈ ਯੋਗਾ ਕਲਾਸ ਕਾ ਹਾਂਜੀ ਹਾਂਜੀ

ਹਾਂਜੀ ਅਤੇ ਕਿੰਨੇ ਬੱਚੇ ਆਉਂਦੇ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਅਤੇ ਕਿੱਥੇ ਕਰਕੇ ਹੈ ਤੁਹਾਡਾ ਇੱਥੇ ਯੋਗਾ ਕਲਾਸ ਕਿਹੜੀ ਜਗ੍ਹਾ ਲੱਗਦੀ ਹੈ ਤੁਹਾਡੀ ਅੱਛਾ ਅੱਛਾ ਅਤੇ ਜੇ ਕੱਲ੍ਹ ਤੋਂ ਜੁਆਇਨ ਕਰਨੀ ਹੋਏ ਤਾਂ ਕੀ ਹਿਸਾਬ ਹੈ ਉਹਦਾ ਫਿਰ ਹਾਂਜੀ ਅਤੇ ਕਿੰਨੇ ਪੈਸੇ ਹੈ ਕਿੰਨੇ ਕਿੰਨੇ ਪੈਸੇ ਲੱਗਦੇ ਓਨੇ ਉਹ ਚਾਰਜਿਸ ਕਿੰਨੇ ਲੱਗਣਗੇ ਉਹਨਾਂ ਦੇ ਅੱਛਾ ਅਤੇ ਕਿਹੜੇ ਕਿਹੜੀ ਚੀਜ਼ ਤੁਸੀਂ ਉਹਦੇ ਵਿੱਚ ਦੱਸ ਰਹੇ ਹੋ ਸਾਨੂੰ ਮਲਕੀ ਕਿੰਨੀ ਕੁ ਐਕਸਰਸਾਈਜ਼ ਦਾ ਤੁਸੀਂ ਸਾਨੂੰ ਉਹਦੇ ਵਿੱਚ ਕਰਵਾਓਗੇ

ਹਾਂਜੀ ਹਾਂਜੀ ਹਾਂਜੀ ਐਪਰੋਕਸ ਕਿੰਨੇ ਕੁ ਬੱਚੇ ਹੋ ਜਾਂਦੇ ਹੈ ਤੁਹਾਡੇ ਕੋਲ ਤੀਹ ਪੈਂਤੀ ਬੱਚੇ ਹੋ ਜਾਂਦੇ ਹੈ ਹਾਂਜੀ ਹਾਂਜੀ ਅਤੇ ਬ ਓਨਲੀ ਵੈਸੇ ਬੱਚੇ ਹੀ ਆਉਂਦੇ ਆ ਜਾਂ ਕੋਈ ਹੋਰ ਵੱਡੇ ਮਤਲਬ ਕਿ ਕੋਈ ਲੇਡੀਜ਼ ਵਗੈਰਾ ਵੀ ਕੋਈ ਤੁਸੀਂ ਜੁਆਇਨ ਕੀਤੇ ਵੇ ਹੈ ਅੱਛਾ ਅੱਛਾ ਤਾਂ ਫਿਰ ਅਸੀਂ ਦੁਪਹਿਰ ਦਾ ਕਰੀਏ ਜਾਂ ਫਿਰ ਸਵੇਰ ਦਾ ਕਰੀਏ ਹਾਂਜੀ ਹਾਂਜੀ ਅਤੇ ਕਿੰਨੇ ਪੈਸੇ ਕਹਿ ਰਹੇ ਹੋ ਤੁਸੀਂ ਉਹਦੇ ਅੱਛਾ ਠੀਕ ਹੈ ਚਲੋ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਾਂਗੀ ਕੀ ਹਿਸਾਬ ਹੈ ਫਿਰ ਮੈਂ ਤੁਹਾਨੂੰ ਕੋਲ ਬੈਕ ਕਰਕੇ ਸਾਰੀ ਗੱਲ ਦੱਸ ਦਾਂਗੀ ਓਕੇ ਬਾਏ